ਸਾਡੀ ਰਸੋਈ ਵਿੱਚ ਬਹੁਤ ਸਾਰੇ ਬਰਤਨ ਹਨ ਬਰਤਨਾਂ ਵਿੱਚ ਬਹੁਤ ਸਾਰੇ ਮਤਲਬ ਬਰਤਨ ਆਉਂਦੇ ਹਨ ਜਿਵੇਂ ਕਿ ਕੌਲੀ ਗਲਾਸ ਪਲੇਟਾਂ ਕੜਾਹੀ ਗੜਵੀਆਂ ਪਤੀਲੇ ਪਤੀਲੀਆਂ ਇਹ ਬਰਤਨ ਰਸੋਈ ਦੇ ਸਾਰੇ ਕੰਮਾਂ ਵਿੱਚ ਵਰਤੇ ਜਾਂਦੇ ਹਨ ਜਿਵੇਂ ਕਿ ਰੋਟੀ ਖਾਣ ਦੇ ਲਈ ਅਸੀਂ ਪਲੇਟਾਂ ਨੂੰ ਵਰਤਦੇ ਹਾਂ ਰੋਟੀ ਨੂੰ ਪਲੇਟ ਦੇ ਵਿੱਚ ਰੱਖ ਕੇ ਮਤਲਬ ਖਾਇਆ ਜਾਂਦਾ ਸਬਜੀ ਸਬਜੀ ਖਾਣ ਦੇ ਲਈ ਅਸੀਂ ਕੌਲੀ ਦੇ ਵਿੱਚ ਸਬਜੀ ਪਾਉਂਦੇ ਹਾਂ ਅਤੇ ਫਿਰ ਉਸ ਦੇ ਹੈ ਇਸ ਤਰ੍ਹਾਂ ਖਾਇਆ ਜਾਂਦਾ ਹੈ ਅਤੇ ਇਸ ਤਰ੍ਹਾਂ ਮਤਲਬ ਚਮਚ ਦੇ ਨਾਲ ਕੌਲੀ ਵਿੱਚੋਂ ਸਬਜੀ ਨੂੰ ਉਠਾ ਕੇ ਮਤਲਬ ਜਿੱਦਾਂ ਮੂੰਹ ਵਿੱਚ ਪਾਉਣਾ ਹੋਵੇ ਤਾਂ ਅਸੀਂ ਇੱਕ ਚਮਚ ਦਾ ਯੂ ਵਰਤੋਂ ਕਰਦੇ ਹਾਂ ਇਸ ਤਰ੍ਹਾਂ ਹੀ ਬਰਤਨਾਂ ਦਾ ਹੋਰ ਵੀ ਮਤਲਬ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ ਬਰਤਨਾਂ ਤੋਂ ਅਸੀਂ ਕਾਫ਼ੀ ਮਤਲਬ ਬਰਤਨਾਂ ਦੀ ਕਾਫ਼ੀ ਵਰਤੋਂ ਕੀਤੀ ਜਾਂਦੀ ਹੈ ਜੇ ਹਨ ਜਿਸ ਤਰ੍ਹਾਂ ਕਿ ਬਰਤਨਾਂ ਨੂੰ ਰਸੋਈ ਦੇ ਵਿੱਚ ਇ ਇਸ ਢੰਗ ਨਾਲ ਰੱਖਿਆ ਜਾਂਦਾ ਹੈ ਜਿਵੇਂ ਕਿ ਜਿਹੜੇ ਬਰ ਬਰਤਨ ਜ਼ਿਆਦਾ ਮਤਲਬ ਵਰਤਨੇ ਹੋਣ ਉਹ ਬਰਤਨ ਰਸੋਈ ਦੇ ਨੇੜੇ ਰੱਖੇ ਜਾਂਦੇ ਹਨ ਜਿਵੇਂ ਕਿ ਕੌਲੀ ਹੋ ਗਈ ਪਲੇਟ ਹੋ ਗਿਆ ਔਰ ਚਮਚ ਹੋ ਗਿਆ ਇਹਨਾਂ ਨੂੰ ਮਤਲਬ ਕਿਆ ਏ ਮਤਲਬ ਨੇੜੇ ਨੇੜੇ ਰੱਖਿਆ ਜਾਂਦਾ ਹੈ ਕਿਉਂਕਿ ਜਿਹੜੇ ਬਰਤਨ ਹੋ ਗਏ ਇਹਨਾਂ ਦੀ ਜ਼ਿਆਦਾ ਵਰਤੋਂ ਹੁੰਦੀ ਹੈ ਕਿਉਂਕਿ ਇਹ ਜਿੱਦਾਂ ਕਿ ਹੁਣ ਅਸੀਂ ਪਾਣੀ ਪੀਣਾ ਹੋਵੇ ਪਾਣੀ ਪੀਣ ਦੇ ਲਈ ਅਸੀਂ ਗਲਾਸ ਦੀ ਵਰਤੋਂ ਥੋੜ੍ਹੇ ਥੋੜ੍ਹੇ ਟਾਈਮ ਬਾਅਦ ਕਰਦੇ ਹੀ ਆਂ ਇਸ ਤਰ੍ਹਾਂ ਮਤਲਬ ਕਿਆ ਏ ਜਿਹੜੇ ਗਲਾਸ ਏ ਰੈਕ ਮਤਲਬ ਜਿ ਜਿੱਥੇ ਭਾਂਡੇ ਰੱਖੇ ਜਾਂਦੇ ਹਨ ਬਰਤਨ ਰੱਖੇ ਜਾਂਦੇ ਹਨ ਉਹ ਰੈਕ ਦੇ ਵਿੱਚ ਰੱਖੇ ਜਾਂਦੇ ਹਨ ਰੈਕ ਦੇ ਵਿੱਚ ਫਿਰ ਜਿੱਦਾਂ ਅਸੀਂ ਪਾਣੀ ਮਤਲਬ ਜ਼ਿਆਦਾ ਪੀਂਦੇ ਹਾਂ ਅਤੇ ਪਾਣ ਪੀਣ ਦੇ ਲਈ ਅਸੀਂ ਕਿਆ ਏ ਜਿਹੜੇ ਗਲਾਸ ਹੈ ਉਹ ਰੈਕ ਦੇ ਵਿੱਚ ਇਸ ਜਗ੍ਹਾ ਰੱਖਦੇ ਹਾਂ ਜਿੱਦਾਂ ਕਿ ਆਪਾਂ ਜਲਦੀ ਉਠਾ ਪਾਈਏ ਇਸ ਤਰ੍ਹਾਂ ਹੀ ਮਤਲਬ ਕਿਆ ਏ ਜਿਹੜੀਆਂ ਪਲੇਟਾਂ ਹੋ ਗਈਆਂ ਪਲੇਟਾਂ ਨੂੰ ਵੀ ਮਤਲਬ ਇਸ ਢੰਗ ਦੇ ਨਾਲ ਰੱਖਿਆ ਜਾਂਦਾ ਕਿ ਉਹ ਉਠਾਣੀਆਂ ਸਾਨੂੰ ਜਲਦੀ ਮਤਲਬ ਹੋ ਜਾਣ ਇਸੇ ਤਰ੍ਹਾਂ ਜਿੱਦਾਂ ਕਿ ਅਸੀਂ ਕੋਈ ਸਬਜੀ ਬਨਾਉਂਦੇ ਹਾਂ ਸਬਜੀ ਬਣਾਉਣ ਦੇ ਲਈ ਕੜਾਹੀਆਂ ਦੀ ਵਰਤੋਂ ਕੀਤੀ ਜਾਂਦੀ ਹੈ ਕੜਾਹੀਆਂ ਅਸੀਂ ਮਤਲਬ ਜ਼ਿਆਦਾ ਵਰਤੋਂ ਨਹੀਂ ਕਰਦੇ ਨਾ ਕੜਾਹੀਆਂ ਦੀ ਇਸ ਲਈ ਅਸੀਂ ਉਹਨਾਂ ਨੂੰ ਮਤਲਬ ਥੋੜ੍ਹਾ ਦੂਰ ਵੀ ਰੱਖ ਦਿੰਦੇ ਹਾਂ ਅਤੇ ਜਿੱਦਾਂ ਕਿ ਆਪਾਂ ਸਬਜੀ ਬਣਾਉਂਦੇ ਹਾਂ ਤਾਂ ਫਿਰ ਸਬਜੀ ਬਣਾਉਣ ਦੇ ਲਈ ਕੜਾਹੀ ਜਾਂ ਫਿਰ ਕੋਈ ਪਤੀਲਾ ਯੂਸ ਕੀਤਾ ਜਾਂਦਾ ਹੈ ਵਰਤੋਂ ਕੀਤੀ ਜਾਂਦੀ ਹੈ ਪਤੀਲੇ ਦੀ ਅਤੇ ਇਹ ਵਰਤੋਂ ਕਰਨ ਦੇ ਨਾਲ ਮਤਲਬ ਇਹਨਾਂ ਨੂੰ ਇਸ ਤਰ੍ਹਾਂ ਦੇ ਨਾਲ ਰੱਖਿਆ ਜਾਂਦਾ ਹੈ ਕਿ ਮਤਲਬ ਜਿੱਦਾਂ ਦੂਰ ਰੱਖ ਦਿੱਤਾ ਜਾਂਦਾ ਏ ਕਿਉਂਕਿ ਇਹ ਮਤਲਬ ਜ਼ਿਆਦਾ ਵਰਤੋਂ ਦੇ ਵਿੱਚ ਨਹੀਂ ਆਉਂਦੇ ਜਿੱਦਾਂ ਕਿ ਹੁਣ ਗੜਵੀ ਹੋ ਗਿਆ ਕੋਈ ਦੁੱਧ ਪਾਉਣ ਦੇ ਲਈ ਗੜਵੀ ਵਿੱਚ ਦੁੱਧ ਰੱਖਣਾ ਹੈ ਨਾ ਅਤੇ ਜਿੱਦਾਂ ਕਿ ਆਪਾਂ ਦੁੱਧ ਗਰਮ ਕਰਦੇ ਹਾਂ ਦੁੱਧ ਗਰਮ ਕਰਨ ਦੇ ਲਈ ਅਸੀਂ ਪਤੀਲੀ ਦੀ ਵਰਤੋਂ ਕਰਦੇ ਹਾਂ ਪਤੀਲੀ ਦੀ ਵਰਤੋਂ ਕਰਨ ਕਰਦੇ ਆਂ ਅਤੇ ਫਿਰ ਦੁੱਧ ਗਰਮ ਹੁੰਦਾ ਏ ਅਤੇ ਫਿਰ ਇਸ ਤਰ੍ਹਾਂ ਉਹ ਫਰਿਜ 'ਚ ਰੱਖਣ ਲਈ ਆਪਾਂ ਗੜਵੀ 'ਚ ਪਾ ਕੇ ਉਹਨੂੰ ਫਰਿਜ ਦੇ ਵਿੱਚ ਰੱਖ ਦਿੰਦੇ ਹਾਂ ਹਾਂ ਇਸ ਤਰ੍ਹਾਂ ਮਤਲਬ ਭਾਂਡਿਆਂ ਦਾ ਮਤਲਬ ਬਰਤਨਾਂ ਨੂੰ ਮਤਲਬ ਰਸੋਈ ਦੇ ਵਿੱਚ ਮਤਲਬ ਮਤਲਬ ਮੇਨ ਕੰਮ ਰਸੋਈ ਦੇ ਵਿੱਚ ਬਰਤਨਾਂ ਦਾ ਹੀ ਹੈ ਬਰਤਨਾਂ ਤੋਂ ਬਿਨ੍ਹਾਂ ਕਿਆ ਏ ਰਸੋਈ ਦੇ ਵਿੱਚ ਜਿਹੜਾ ਕੰਮ ਹੈ ਉਹ ਹੋ ਨਹੀ ਸਕਦਾ ਕਿਉਂਕਿ ਜਿਹੜੇ ਰਸੋਈ ਦੇ ਵਿੱਚ ਹਰ ਇੱਕ ਕੰਮ ਏ ਉਹ ਬਰਤਨ ਨਾਲ ਹੀ ਆ ਬਰਤਨਾਂ ਤੋਂ ਬਿਨ੍ਹਾਂ ਤਾਂ ਕੋਈ ਕੰਮ ਵੀ ਰਸੋਈ ਦੇ ਵਿੱਚ ਹੋ ਹੀ ਨਹੀ ਸਕਦਾ ਮਤਲਬ ਬਰਤਨ ਮਤਲਬ ਰਸੋਈ ਦੇ ਵਿੱਚ ਬਰਤਨ ਬਹੁਤ ਜ਼ਰੂਰੀ ਹੈ ਕਿਉਂਕਿ ਆਪਾਂ ਕੋਈ ਵੀ ਕੰਮ ਕਰਨਾ ਹੋਵੇ ਜਿਵੇਂ ਕਿ ਮਤਲਬ ਸਬਜ਼ੀ ਨੂੰ ਹਲਾਉਣਾ ਹੋਵੇ ਸਬਜ਼ੀ ਬਣਾਉਣੀ ਹੋਵੇ ਸਬਜ਼ੀ ਨੂੰ ਖਾਣਾ ਹੋਵੇ ਖਾਣਾ ਪੀਣਾ ਸਭ ਕੁਛ ਕਿਆ ਏ ਬਰਤਨਾਂ ਦੀ ਮਦਦ ਦੇ ਨਾਲ ਹੀ ਹੁੰਦਾ ਹੈ ਇਸ ਤਰ੍ਹਾਂ ਅਸੀਂ ਇਡ ਬਰਤਨਾਂ ਦੀ ਮਦਦ ਤੋਂ ਬਿਨਾਂ ਕਿਆ ਏ ਰਸੋਈ ਦਾ ਕੋਈ ਵੀ ਕੰਮ ਨਹੀ ਹੋ ਸਕਦਾ ਜਿੱਦਾਂ ਕਿ ਪਾਣੀ ਤੋਂ ਬਿਨਾਂ ਆਪਾਂ ਘਰ ਦਾ ਕੋਈ ਕੰਮ ਨਹੀਂ ਕਰ ਸਕਦੇ ਇਸ ਤਰ੍ਹਾਂ ਬਰਤਨਾਂ ਤੋਂ ਬਿਨਾਂ ਅਸੀਂ ਰਸੋਈ ਦਾ ਕੋਈ ਕੰਮ ਨਹੀਂ ਕਰ ਸਕਦੇ ਇਸ ਲਈ ਜਿਹੜੇ ਬਰਤਨ ਹੈ ਇੱਕ ਰਸੋਈ ਦੇ ਵਿੱਚ ਬਹੁਤ ਮਹੱਤਵਪੂਰਨ ਜਿਹੜਾ ਹੈਗਾ ਏ ਸਥਾਨ ਉਹ ਰੱਖਦੇ ਹਨ ਮਹੱਤਵਪੂਰਨ ਸਥਾਨ ਰੱਖਣ ਦੇ ਨਾਲ ਮਤਲਬ ਕਿਆ ਏ ਬਹੁਤ ਮਤਲਬ ਮਹੱਤਵਪੂਰਨ ਹੈ ਰਸੋਈ ਦੇ ਮਤਲਬ ਸਮਾਨ ਦੇ ਲਈ ਇਹਦੇ ਵਿੱਚ ਬਹੁਤ ਸਾਰੇ ਬਰਤਨ ਆਉਂਦੇ ਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸਿਆ ਹੈ